ਜੇ ਤੁਸੀਂ ਐਕਸਰਸਾਈਜ਼ ਕਰਦੇ ਹੋ ਤਾਂ ਤੁਹਾਨੂੰ ਬੈਲੇਂਸ ਡਾਈਟ ਦੀ ਬਹੁਤ ਲੋੜ ਹੁੰਦੀ ਹੈ ਜਦੋਂ ਤੁਸੀਂ ਦੌੜਦੇ ਹੋ ਤਾਂ ਤੁਹਾਡੇ ਕਈ ਮਸਲਸ ਬ੍ਰੇਕ ਹੁੰਦੇ ਹਨ ਜਿਸ ਨੂੰ ਰਿਕਵਰ ਕਰਨ ਲਈ ਤੁਹਾਨੂੰ ਬੈਲੇਂਸ ਡਾਈਟ ਲੈਣੀ ਹੀ ਪੈਂਦੀ ਹੈ ਅਤੇ ਸਵੈਟਿੰਗ ਵੀ ਬਹੁਤ ਹੁੰਦੀ ਹੈ ਜਿਸ ਨਾਲ ਡੀਹਾਈਡ੍ਰੇਸ਼ਨ ਹੋਣ ਦਾ ਖਤਰਾ ਹੁੰਦਾ ਹੈ ਰਨਿੰਗ ਕਰਨ ਤੋਂ ਬਾਅਦ ਪਾਣੀ ਅਤੇ ਫਾਈਬਰ ਡਾਈਟ ਜਾਂ ਪ੍ਰੋਟੀਨ ਡਾਈਟ ਲੈਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਡਾਈਟ ਠੀਕ ਨਹੀਂ ਲਉਗੇ ਤਾਂ ਤੁਹਾਨੂੰ ਹੋਰ ਕਮਜ਼ੋਰੀ ਆਏਗੀ ਜਿਸ ਨਾਲ ਤੁਹਾਨੂੰ ਅੱਗੇ ਬਹੁਤ ਦਿੱਕਤਾਂ ਆ ਸਕਦੀਆਂ ਹਨ